ਤਕਨੋਲਜੀ ਇੱਕ ਤਰ੍ਹਾਂ ਨਾਲ ਸਾਡੇ ਲਈ ਵਧੀਆ ਚੀਜ਼ ਵੀ ਹੈ ਪਰ ਕਿਤੇ ਨਾ ਕਿਤੇ ਇਹਦੇ ਨੁਕਸਾਨ ਵੀ ਹੈ ਤਕਨੋਲਜੀ ਦੇ ਨਾਲ ਮਨੋਰੰਜਨ ਬਿਲਕੁਲ ਬਦਲ ਗਿਆ ਕਿਉਂਕਿ ਜਦੋਂ ਪਹਿਲਾਂ ਟੈਕਨੋਲਜੀ ਨਹੀਂ ਸੀਗੀ ਉਦੋਂ ਉਦੋਂ ਸਾਰੇ ਇਕੱਠੇ ਬਹਿੰਦੇ ਹੁੰਦੇ ਸੀ ਤਾਂ ਸਾਰੇ ਘਰ 'ਚ ਇਕੱਠੇ ਬੈਠਣਾ ਮੰਮ ਮਾਤਾ ਪਿਤਾ ਕੋਲ ਇਕੱਠੇ ਬੈਠਣਾ ਭੈਣ ਭਰਾਵਾਂ ਦੁੱਖ ਸੁੱਖ ਸਾਂਝੇ ਕਰਨੇ ਬਾਹਰ ਬਾਹਰ ਦੀਆਂ ਖੇਲਾਂ ਖੇਲਣੀਆਂ ਕੁੜੀਆਂ ਨੇ ਗੀਟੇ ਖੇਡਣੇ ਮੁੰਡਿਆਂ ਨੇ ਬਾਹਰ ਜਾ ਕੇ ਕ੍ਰਿਕਟ ਖੇਡਣੀ ਇਸ ਤਰ੍ਹਾਂ ਦੇ ਸੀਗੇ ਮਨੋਰੰਜਨ ਦੇ ਸਾਧਨ ਹੁਣ ਜਦੋਂ ਟਕਨੋਲਜੀ ਆ ਗਈ ਜਦੋਂ ਅੱਜ ਕੱਲ੍ਹ ਫੋਨ ਆ ਗਏ ਤਾਂ ਤਾਂ ਫੋਨ ਤੇ ਆਉਣ ਨਾਲ ਕਿਤੇ ਨਾ ਕਿਤੇ ਜਿਹੜਾ ਮਨੋਰੰਜਨ ਹੈ ਉਹ ਬਿਲਕੁਲ ਬਦਲ ਚੁੱਕਾ ਹੈ ਕਿਉਂਕਿ ਪਹਿਲਾਂ ਤਾਂ ਕਮੇਡੀ ਆਪਾਂ ਕਮੇਡੀ ਜਾ ਕੇ ਦੇਖਦੇ ਹੁੰਦੇ ਸੀਗੇ ਕਿਤੇ ਮੇਲਾ ਲੱਗਣਾ ਤਾਂ ਉੱਥੇ ਚਲ ਜਾਣਾ ਕਿਤੇ ਕੋਈ ਭੰਡਾ ਨੇ ਨਾਟਕ ਕਰਦੇ ਹੋਣਾ ਉੱਥੇ ਚਲ ਜਾਣਾ ਤਾਂ ਅਸੀਂ ਉਹ ਨੁਕਰ ਨਾਟਕ ਦੇਖਦੇ ਹੁੰਦੇ ਸੀ ਪਰ ਹੁਣ ਤਾਂ ਸਭ ਕੁਝ ਬਦਲ ਗਿਆ ਕਿਉਂਕਿ ਹੁਣ ਸਾਡੇ ਕੋਲ ਸਮਾਰਟ ਫੋਨਸ ਆ ਗਏ ਨੇ ਹੁਣ ਤਾਂ ਉਹਦੇ ਵਿੱਚ ਈ ਵੀਡੀਓਜ਼ ਹੈ ਉਹਦੇ ਵਿੱਚ ਹੀ ਆਡੀਓਜ ਆ ਅਸੀਂ ਉਹੀ ਸਾਰਾ ਦਿਨ ਬੈਠੇ ਉਹਨੂੰ ਉੱਪਰ ਸਕਰੋਲ ਕਰਦੇ ਰਹਿੰਦੇ ਨੇ ਆਪਾਂ ਸੋਸ਼ਲ ਮੀਡੀਆ 'ਤੇ ਇੰਨਾ ਜ਼ਿਆਦਾ ਐਕਟਿਵ ਹੋ ਗਏ ਨੇ ਇੰਸਟਗ੍ਰਾਮ ਚਲਾਉਣ ਲੱਗ ਗਏ ਫੇਸਬੁੱਕ ਚਲਾਉਣ ਲੱਗ ਗਏ ਯੂਟਿਊਬ ਉਹ 'ਤੇ ਕਿੰਨੀਆਂ ਸਾਰੀਆਂ ਵੀਡੀਓਜ ਆ ਜਾਂਦੀਆਂ ਨੇ ਸਾਨੂੰ ਅਸੀਂ ਸੋਚਦੇ ਹੀ ਨਹੀਂ ਪਹਿਲਾਂ ਪਹਿਲਾਂ ਲੋਕ ਇਕੱਠੇ ਹੋ ਕੇ ਟੀ ਵੀ ਦੇਖਦੇ ਹੁੰਦੇ ਸੀ ਕਿਸੇ ਇੱਕ ਘਰ 'ਚ ਟੀ ਵੀ ਹੁੰਦਾ ਸੀ ਤਾਂ ਜਦੋਂ ਕਿਤੇ ਸ਼ਕਤੀਮਾਨ ਲੱਗਣਾ ਜਾਂ ਕਿਤੇ ਰਮਾਇਣ ਆਉਣੀ ਤਾਂ ਸਾਰਿਆਂ ਨੇ ਇਕੱਠੇ ਹੋ ਜਾਣਾ ਇਕੱਠੇ ਹੋ ਕੇ ਬਹਿ ਕੇ ਵੇਖਣਾ ਤਾਂ ਉਹ ਸਾਰਿਆਂ ਲਈ ਇੱਕ ਵਧੀਆ ਸੀਗਾ ਇੱਕ ਮਨੋਰੰਜਨ ਦਾ ਸਾਧਨ ਵਧੀਆ ਸੀ ਤਾਂ ਉਹਨਾਂ 'ਚ ਇੱਕ ਇੱਕ ਤਾਂ ਜੁੱਟਤਾ ਸੀ ਹੁਣ ਤਾਂ ਫੋਨ ਹੈ ਤਾਂ ਹਰ ਘਰ 'ਚ ਜਿੰਨੇ ਘਰ ਦੇ ਜੀਅ ਨੇ ਜਿੰਨੇ ਘਰ 'ਚ ਮੈਂਬਰ ਨੇ ਓਨੇ ਉਹਨਾਂ ਦੇ ਕੋਲ ਫੋਨ ਹੈ ਤਾਂ ਆਪਣੇ ਫੋਨਾਂ ਦੇ ਵਿੱਚ ਵੜ ਜਾਂਦੇ ਨੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਇਸ ਤਰ੍ਹਾਂ ਮਨੋਰੰਜਨ ਦੇ ਸਾਧਨ ਤਾਂ ਹੋਏ ਹੋਏ ਹੈ ਬਦਲੇ ਹੀ ਬਦਲੇ ਹੈ ਪਰ ਇਸ ਤਰਾਂ ਨਾਲ਼ ਰਿਸ਼ਤਿਆਂ 'ਤੇ ਵੀ ਬਹੁਤ ਜ਼ਿਆਦਾ ਇਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਏ